ਹਾਂ ਭੰਗੜਾ ਐਰੋਬਿਕਸ ਸਰੀਰਕ ਗਤੀਵਿਧੀ ਦੇ ਤੌਰ ਤੇ ਵਧੀਆ ਕਸਰਤ ਹੈ ਭੰਗੜਾ ਫਿੱਟ ਹੋਣ ਦਾ ਇੱਕ ਸ਼ਾਨਦਾਰ ਤਰੀਕਾ ਹੈ ਇਹ ਪੰਜਾਬ ਭਾਰਤ ਤੋਂ ਇੱਕ ਉੱਚ ਊਰਜਾ ਵਾਲਾ ਡਾਂਸ ਫਾਰਮ ਹੈ ਅਤੇ ਇਹ ਸਿਹਤ ਤਾਕਤ ਅਤੇ ਤਾਲਮੇਲ ਲਈ ਬਹੁਤ ਵਧੀਆ ਹੈ ਤੇਜ਼ ਰਫਤਾਰ ਤਾਲਬਧ ਹਰਕਤਾਂ ਕੈਲੋਰੀਆਂ ਨੂੰ ਸਾੜ ਸਕਦੀਆਂ ਹਨ ਅਤੇ ਸਮੁੱਚੀ ਤੰਦਰੁਸਤੀ ਵਿੱਚ ਸੁਧਾਰ ਕਰ ਸਕਦੀਆਂ ਹਨ ਭੰਗੜੇ ਤੋਂ ਪ੍ਰੇਰਿਤ ਖਾਸ ਅਭਿਆਨ ਇਸ ਤਰ੍ਹਾਂ ਹਨ ਵਾਰਮ ਅਪ ਆਪਣੇ ਸਰੀਰ ਨੂੰ ਤਿਆਰ ਕਰਨ ਲਈ ਕੁਝ ਕੋਮਲ ਖਿੱਚਣ ਅਤੇ ਸਧਾਰਨ ਅੰਦੋਲਨਾਂ ਨਾਲ ਸ਼ੁਰੂ ਕਰੋ ਤੁਸੀਂ ਹੌਲੀ ਹੌਲੀ ਆਪਣੇ ਦਿਲ ਦੀ ਧੜਕਨ ਨੂੰ ਵਧਾਉਣ ਲਈ ਮੁੱਢਲੇ ਭੰਗੜੇ ਦੇ ਕਦਮਾਂ ਨੂੰ ਸ਼ਾਮਿਲ ਕਰ ਸਕਦੇ ਹੋ ਮੁੱਢਲੇ ਕਦਮ ਝੂਮਰ ਇੱਕ ਪਾਸੇ ਤੋਂ ਪਾਸੇ ਦੀ ਲਹਿਰ ਜਾਂ ਬੱਲੇ ਬੱਲੇ ਜਸ਼ਨ ਮਨਾਉਣ ਵਾਲੀ ਛਾਲ ਵਰਗੇ ਬੁਨਿਆਦੀ ਭੰਗੜੇ ਦੇ ਕਦਮਾਂ ਦਾ ਅਭਿਆਸ ਕਰੋ ਇਹ ਅੰਦੋਲਨ ਇੱਕ ਕਾਰਡੀਓ ਕਸਰਤ ਬਣਾਉਣ ਲਈ ਇੱਕ ਲੜੀ ਵਿੱਚ ਕੀਤੇ ਜਾ ਸਕਦੇ ਹਨ ਪੂਰੀ ਰੁਟੀਨ ਭੰਗੜੇ ਦੇ ਵੱਖ ਵੱਖ ਕਦਮਾਂ ਅਤੇ ਪੈਟਰਨਾਂ ਨੂੰ ਸ਼ਾਮਿਲ ਕਰਦੇ ਹੋਏ ਇੱਕ ਡਾਂਸ ਰੁਟੀਨ ਬਣਾਓ ਉਦਾਹਰਨ ਲਈ ਤੁਸੀਂ ਉੱਚੇ ਗੋਡਿਆਂ ਅਤੇ ਛਾਲ ਮਾਰਨ ਦੀਆਂ ਹਰਕਤਾਂ ਦੇ ਨਾਲ ਗਿੱਡਾ ਇੱਕ ਘੁੰਮਣ ਵਾਲੀ ਗਤੀ ਵਰਗੇ ਕਦਮਾਂ ਨੂੰ ਮਿਲਾ ਸਕਦੇ ਹੋ ਤਾਕਤ ਦੀ ਸਿਖਲਾਈ ਭੰਗੜੇ ਤੋਂ ਪ੍ਰੇਰਿਤ ਅੰਦੋਲਨ ਨੂੰ ਸ਼ਾਮਿਲ ਕਰੋ ਜਿਸ ਵਿੱਚ ਸਕੁਐਸਟ ਲੰਗਜ ਅਤੇ ਬਾਂਹ ਚੁੱਕਣਾ ਸ਼ਾਮਿਲ ਹੈ ਉਦਾਹਰਣ ਲਈ ਚੱਕਰ ਨੂੰ ਲੱਤਾਂ ਦੀ ਤਾਕਤ ਵਧਾਉਣ ਲਈ ਸਕੁਐਸਟ ਨਾਲ ਜੋੜਿਆ ਜਾ ਸਕਦਾ ਹੈ